ਇੱਕ ਸੈਮਸੱਗ ਦੇ ਫ਼ਰਿੱਜ ਦੇ ਲੈਣ ਤੋਂ ਪਹਿਲਾਂ ਮੇਰੇ ਕੋਲ ਹਿਟਾਚੀ ਦਾ ਫ਼ਰਿੱਜ ਹੁੰਦਾ ਸੀਗਾ ਫਰੈਸ ਸਟੋਰ ਛੇ ਸੌ ਕੁਛ ਲੀਟਰ ਮੌਡਲ ਦਾ ਬੜਾ ਬੇਕਾਰ ਐਕਸਪੀਰੀਅਸ ਹੋਇਆ ਮੇਰਾ ਉਹਦੇ ਨਾਲ ਉਹ ਫ਼ਰਿੱਜ ਦੇ ਅੰਦਰ ਨਾ ਤਾਂ ਕੋਆਲੀਟੀ ਤੀ ਨਾ ਹੀ ਉਹਦੇ ਅੰਦਰ ਸਪੇਸ ਹੁੰਦਾ ਸੀਗਾ ਹਾਲਾਂਕਿ ਉਹ ਛੇ ਸੌ ਕੁਛ ਲੀਟਰ ਦਾ ਤਾ ਔਰ ਉਹਦੀ ਦੀ ਨਾ ਕੂਲਿੰਗ ਦੀ ਸਿਸਟਮ ਏ ਬੜਾ ਬੇਕਾਰ ਸੀਗਾ ਉਹਨਾਂ ਦਾ ਜੇ ਦੋ ਦਿਨ ਜਾਂ ਤਿੰਨ ਦਿਨ ਤੁਸੀਂ ਇੰਨ ਕੇਸ ਕਿਤੇ ਉਹਦੇ 'ਚ ਕੋਈ ਚੀਜ਼ ਛੱਡਤੀ ਨਹੀਂ ਦੇਖੀ ਚਾਹੇ ਸਬਜ਼ੀ ਹੈ ਦੁੱਧ ਹੈ ਅਤੇ ਚਾਹੇ ਆਟਾ ਵੀ ਹੈ ਉਹ ਖ਼ਰਾਬ ਹੋਣ ਦੇ ਕਿਨਾਰੇ 'ਤੇ ਆ ਜਾਂਦੀ ਸੀਗੀ ਚੀਜ਼ ਉਹ ਉਹ ਬੜਾ ਬੜਾ ਬੇਕਾਰ ਜਿਹਾ ਐਕਸਪੀਰੀਐਂਸ ਲੱਗਿਆ ਔਰ ਬੜਾ ਐਕਸਪੈਨਸਿਵ ਵੀ ਸੀਗਾ ਤਕਰੀਬਨ ਸੱਤਰ ਹਜ਼ਾਰ ਦੇ ਆਸ ਪਾਸ ਅਸੀਂ ਫ਼ਰਿੱਜ ਲਿਤਾ ਤਾ ਉਹ ਤਾਂ ਮਜ਼ਾ ਨਹੀਂ ਆਇਆ ਉਹ ਸੈਮਸੱਗ 'ਤੇ ਘੱਟ ਪੈਸੇ ਲਗਾ ਕੇ ਵੀ ਮੈਨੂੰ ਜ਼ਿਆਦਾ ਬੈਨੀਫਿੱਟ ਮਿਲੇ ਆ ਉਹਦੇ 'ਤੇ ਮੈਨੂੰ ਜ਼ਿਆਦਾ ਪੈਸੇ ਲਗਾ ਕੇ ਵੀ ਲੋਸ ਹੋ ਗਿਆ